ਜਿਵੇਂ ਕਿ ਸਾਡੇ ਫਤਿਹਗੜ੍ਹ ਦੀਆਂ ਖੇਡਾਂ ਨੇ ਅਤੇ ਉਹ ਸਾਡੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ ਗਰਾਉਂਡ ਵਿੱਚ ਹੁੰਦੀਆਂ ਨੇ ਸਾਰੇ ਹੀ ਇਲਾਕੇ ਦੇ ਬੱਚੇ ਸਕੂਲ ਤੇ ਉਰੇ ਖੇਡਣ ਆਉਂਦੇ ਨੇ ਅਤੇ ਜਿਵੇਂ ਚੱਕਰ ਵਿਧੀ ਹੁੰਦੇ ਨੇ ਜਿਵੇਂ ਕਿ ਸਾਲ ਦੇ ਸਾਲ ਮਗਰੋਂ ਮੇਲੇ ਆਉਂਦੇ ਨੇ ਜਿਵੇਂ ਕਿ ਰੋਜ਼ਾ ਸ਼ਰੀਫ ਦਾ ਹੋ ਗਿਆ ਅਤੇ ਸਾਲ ਦੇ ਵਿੱਚ ਦੋ ਵਾਰੀ ਆਉਂਦਾ ਹੈ ਅਤੇ ਉਹਦੇ ਵਿੱਚ ਸਾਰੇ ਹੀ ਮੁਸਲਮਾਨ ਭਾਈ ਮੱਥਾ ਟੇਕਣ ਅਤੇ ਨਮਾਜ਼ ਪੜ੍ਹਨ ਆਉਂਦੇ ਨੇ ਅਤੇ ਜਿਨ੍ਹਾਂ ਦੇ ਉਹ ਹੁੰਦੇ ਨੇ ਜੀ ਉਹਨਾਂ ਵਾਸਤੇ ਦੁਆਵਾਂ ਕਰਦੇ ਨੇ ਅਤੇ ਜਿਵੇਂ ਆਪਣਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੁਣ ਸ ਸਿੰਘ ਸਭਾ ਆਊਗੀ ਇਹਦੇ ਵਿੱਚ ਵੀ ਬਹੁਤ ਦੂਰੋਂ ਦੂਰੋਂ ਲੋਕ ਇਸ ਮੱਥਾ ਟੇਕਣ ਵਾਸਤੇ ਅਤੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ ਉਰੇ